ਭੰਗੜਾ ਐਰੋਬਿਕਸ ਵਿਚ ਮੈਨੂੰ ਸਭ ਤੋਂ ਵੱਡੀ ਚੁਣੌਤੀ ਤਾਲਮੇਲ ਅੱਗੇ ਗਤੀ ਲੱਗਦੀ ਹੈ ਭੰਗੜੇ ਦੇ ਕਦਮ ਤੇਜ਼ ਅਤੇ ਊਰਜਾਵਨ ਹੁੰਦੇ ਹਨ ਅਤੇ ਉਹਨਾਂ ਨੂੰ ਸੰਗੀਤ ਨਾਲ ਮਿਲਾਉਣਾ ਮੁਸ਼ਕਿਲ ਹੋ ਸਕਦਾ ਹੈ ਇਸ ਤੋਂ ਇਲਾਵਾ ਕਈ ਵਾਰ ਮੈਨੂੰ ਆਪਣੇ ਸਾਹ ਲੈਣ ਦੀ ਗਤੀ ਨੂੰ ਕੰਟਰੋਲ ਕਰਨਾ ਵੀ ਮੁਸ਼ਕਿਲ ਲੱਗਦਾ ਹੈ ਖ਼ਾਸ ਕਰਕੇ ਜਦੋਂ ਮੈਂ ਥੱਕ ਜਾਂਦਾ ਹਾਂ ਇਹਨਾਂ ਚੁਣੌਤੀਆਂ ਨੂੰ ਪਾਰ ਕਰਨ ਲਈ ਮੈਨੂੰ ਨਿਯਮਤ ਤੌਰ 'ਤੇ ਅਭਿਆਸ ਕਰਦਾ ਹਾਂ ਮੈਂ ਹੌਲੀ ਸ਼ੁਰੂਆਤ ਕਰਦਾ ਹਾਂ ਅਤੇ ਹੌਲੀ ਹੌਲੀ ਆਪਣੀ ਗਤੀ ਵਧਾਉਂਦਾ ਹਾਂ ਮੈਂ ਸੰਗੀਤ ਨੂੰ ਧਿਆਨ ਨਾਲ ਸੁਣਦਾ ਹਾਂ ਅਤੇ ਕਦਮਾਂ ਨੂੰ ਸਹੀ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜਦੋਂ ਮੈਂ ਥੱਕ ਜਾਂਦਾ ਹਾਂ ਤਾਂ ਮੈਂ ਥੋੜ੍ਹਾ ਸਮਾਂ ਆਰਾਮ ਕਰਦਾ ਹਾਂ ਅਤੇ ਫਿਰ ਦੁਬਾਰਾ ਸ਼ੁਰੂ ਕਰਦਾ ਹਾਂ ਮੈਂ ਇਹ ਵੀ ਯਕੀਨ ਬਣਾਉਂਦਾ ਹਾਂ ਕਿ ਮੈਨੂੰ ਆਪਣੇ ਸਾਹ ਲੈਣ ਦੀ ਗਤੀ 'ਤੇ ਧਿਆਨ ਦੇਣਾ ਚਾਹੀਦਾ ਜੋ ਮੈਂ ਲੰਬੇ ਸਮੇਂ ਤੱਕ ਹੋਰ ਜਾਵਾਂ ਰਹਿ ਸਕਾਂ